ਚੌਵੀ ਮਾਰਚ ਉੱਨੀ ਸੌ ਬਵੰਜਾ ਬਾਈ ਅਪ੍ਰੈਲ ਉੱਨੀ ਸੌ ਉਣਾਸੀ ਛੇ ਜਨਵਰੀ ਉੱਨੀ ਸੌ ਅੱਸੀ ਚਾਰ ਜਨਵਰੀ ਉੱਨੀ ਸੌ ਚੁਰਾਸੀ ਛੱਬੀ ਫਰਵਰੀ ਵੀਹ ਸੌ ਚੌਵੀ